ਅਸੀਂ ਆਪਣੀ ਬਾਗ਼ਬਾਨੀ ਵਿੱਚ ਜੋ ਪੌਦੇ ਲਾਉਂਦੇ ਹਾਂ ਉਹਨਾਂ ਨੂੰ ਪ੍ਰਾਪਤ ਕਰਨਾ ਇੱਕ ਦੂਜੇ ਤੋਂ ਕਿਸੇ ਦੇ ਵੀ ਜੋ ਵਧੀਆ ਚੀਜ਼ ਸਾਨੂੰ ਲੱਗਦੀ ਹੈ ਅਸੀਂ ਉੱਥੋਂ ਪ੍ਰਾਪਤ ਕਰ ਲੈਂਦੇ ਹਾਂ ਜਾਂ ਜਿਹੜੇ ਪੌਦੇ ਹਨ ਬੂਟੇ ਹਨ ਉਹ ਅਸੀਂ ਨਰਸਰੀ ਤੋਂ ਲੈਂਦੇ ਹਾਂ ਕਿਉਂਕਿ ਨਰਸਰੀ ਵਾਲ਼ੇ ਜਿਹੜੇ ਪੌਦੇ ਜਾਂ ਬੂਟੇ ਮਿਲਦੇ ਹਨ ਉਹ ਸਾਫ਼ ਸੁਥਰੇ ਅਤੇ ਨਸਲ ਵਾਲੇ ਹੁੰਦੇ ਹਨ ਜਿਵੇਂ ਕਿ ਲੁਧਿਆਣੇ ਵਿੱਚ ਯੂਨੀਵਰਸਿਟੀ ਹੈ ਉੱਥੋਂ ਸਾਫ਼ ਸੁਥਰੇ ਬੀਜਾਂ ਦੇ ਜਿਹੜੇ ਪੌਦੇ ਹਨ ਉਹ ਮਿਲ ਜਾਂਦੇ ਹਨ ਅਤੇ ਵਧੀਆ ਵਰਾਇਟੀ ਮਿਲਦੀ ਹੈ ਜਿਸਨੂੰ ਲਾ ਕੇ ਅਸੀਂ ਆਪਣੇ ਆਪਣੇ ਲਈ ਵਧੀਆ ਫ਼ਲ ਜਾਂ ਆਪਣੇ ਲਈ ਵਧੀਆ ਫੁੱਲ ਆਪਣੀ ਬਾਗ਼ਬਾਨੀ ਵਿੱਚ ਲਗਾ ਸਕਦੇ ਹਾਂ ਇਸ ਲਈ ਸ੍ਰੋਤ ਤਾਂ ਇਹ ਹੀ ਵਰਤਿਆ ਜਾਂਦਾ ਹੈ ਕਿ ਜ਼ਿਆਦਾਤਰ ਤਾਂ ਨਰਸਰੀਆਂ ਤੋਂ ਹੀ ਬੂਟੇ ਪ੍ਰਾਪਤ ਹੁੰਦੇ ਹਨ ਜਾਂ ਪਿੰਡਾਂ ਦੇ ਵਿੱਚ ਅੱਜ ਕੱਲ੍ਹ ਜੋ ਮਾਲੀ ਹਨ ਉਹ ਵੀ ਪਿੰਡਾਂ ਦੇ ਵਿੱਚ ਜਾ ਜਾ ਕੇ ਬੂਟੇ ਵੇਚਦੇ ਹਨ ਜਿਵੇਂ ਦੇ ਆਪਾਂ ਨੂੰ ਫੁੱਲ ਕਿਤੋਂ ਵਧੀਆ ਲੱਗਦੇ ਹਨ ਆਪਾਂ ਉੱਥੋਂ ਵੀ ਉਹਨਾਂ ਨੂੰ ਲੈ ਆਉਂਦੇ ਹਾਂ ਇਸ ਤਰ੍ਹਾਂ ਆਪਣੀ ਜਿਹੜੀ ਬਾਗ਼ਬਾਨੀ ਹੈ ਉਹ ਆਪਾਂ ਵਧੀਆ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ